ਸਾਡੇ ਇਲਾਕੇ ਵਿੱਚ ਸਰਕਾਰ ਨੇ ਵਿਕਾਸ ਲਈ ਕਈ ਨੀਤੀਆਂ ਅਪਣਾਈਆਂ ਹਨ ਉਹਨਾਂ ਨਾਲ ਅੰਮ੍ਰਿਤਸਰ ਦਾ ਕਾਫ਼ੀ ਵਿਕਾਸ ਹੋਇਆ ਹੈ ਜਿਵੇਂ ਕਿ ਸਰਕਾਰ ਨੇ ਪਹਿਲਾਂ ਤਾਂ ਸਿਹਤ ਸੇਵਾਵਾਂ ਦੇ ਲਈ ਕਈ ਨਵੇਂ ਹਸਪਤਾਲ ਬਣਾਏ ਹਨ ਕਈ ਐਂਬੂਲੈਂਸ ਵੀ ਲਗਾਈਆਂ ਹਨ ਜਿਸ ਨਾਲ ਸਾਨੂੰ ਬਹੁਤ ਸੁੱਖ ਹੋਇਆ ਸਰਕਾਰ ਨੇ ਕਈ ਸਕੂਲ ਵੀ ਖੁਲਵਾਏ ਹਨ ਤਾਂ ਜੋ ਸਿੱਖਿਆ ਪੱਧਰ ਨੂੰ ਉੱਚਾ ਲੈ ਜਾਇਆ ਜਾ ਸਕੇ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਨੂੰ ਜੋੜਨ ਲਈ ਕਈ ਸੜਕਾਂ ਬਣਾਈਆਂ ਹਨ ਸਾਡੇ ਅੰਮ੍ਰਿਤਸਰ ਵਿੱਚ ਸਰਕਾਰ ਨੇ ਕਾਫ਼ੀ ਵਿਕਾਸ ਕੀਤਾ ਹੈ